ਪੰਜਾਬ ਇੱਕ ਖੇਤੀ ਬਾੜੀ ਨਾਲ ਸੰਬੰਧਤ ਸੂਬਾ ਹੈ ਜਿਸ ਵਿੱਚ ਆਮ ਪਿੰਡਾਂ ਦੇ ਵਿੱਚ ਜਨਤਾ ਬਹੁਤ ਸਾਰੀ ਦੁਨੀਆ ਇੱਥੇ ਰਹਿੰਦੀ ਹੈ ਔਰ ਇਹਦੇ ਨਾਲ ਕਿੱਤਾ ਜਿਹੜਾ ਹੈ ਉਹ ਮੁਖੀ ਜਾਨਵਰਾਂ ਨਾਲ ਸੰਬੰਧਿਤ ਬਹੁਤ ਸਾਰੇ ਕਿੱਤੇ ਸ਼ੁਰੂ ਕੀਤੇ ਜਾਂਦੇ ਹਨ ਆਮ ਘਰਾਂ ਦੇ ਵਿੱਚ ਲੋਕ ਦੁੱਧ ਵਾਸਤੇ ਮੱਝਾਂ ਗਾਵਾਂ ਬੱਕਰੀਆਂ ਆਦਿ ਪਾਲਦੇ ਹਨ ਭੇਡਾਂ ਨੂੰ ਵੀ ਪਾਲਿਆ ਜਾਂਦਾ ਹੈ ਸਰਕਾਰ ਸਮੇਂ ਸਮੇਂ 'ਤੇ ਅਲੱਗ ਅਲੱਗ ਸੰਸਥਾਵਾਂ ਨੂੰ ਪਿੰਡਾਂ ਦਿਆਂ ਸਰਪੰਚਾਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਧਾਉਣ ਵਾਸਤੇ ਉਹਨਾਂ ਦੇ ਪਿੰਡਾਂ ਦੇ ਵਿਕਾਸ ਵਾਸਤੇ ਅਲੱਗ ਅਲੱਗ ਸਹੂਲਤਾਂ ਦਿੰਦੀ ਹੈ ਜਿਹਦੇ ਵਿੱਚ ਆਮ ਪਿੰਡਾਂ ਵਾਲਿਆਂ ਨੂੰ ਮੱਝਾਂ ਨੂੰ ਔਰ ਗਾਵਾਂ ਵਾਸਤੇ ਲੋਨ ਦਿੱਤੇ ਜਾਂਦੇ ਹਨ ਜਿਹਦੇ ਵਿੱਚ ਉਹ ਆਪਣੀਆਂ ਗਰੀਬ ਕਿਸਾਨ ਜਾਂ ਹੋਰ ਗਰੀਬ ਲੋਕ ਮੱਝਾਂ ਗਾਵਾਂ ਖਰੀਦ ਕੇ ਔਰ ਉਹਨਾਂ ਨੂੰ ਪਾਲ ਕੇ ਉਹਨਾਂ ਦੇ ਤੋਂ ਦੁੱਧ ਦੀ ਆਮ ਵੇਚ ਕੇ ਦੁੱਧ ਦੀ ਆਮਦਨ ਲੈ ਸਕਦੇ ਹਨ ਇਸੇ ਤਰ੍ਹਾਂ ਹੀ ਬੱਕਰੀਆਂ ਪਾਲ ਕੇ ਅਤੇ ਬੱਕਰੀਆਂ ਬੱਕਰੇ ਵੇਚ ਕੇ ਉਹਨਾਂ ਦਾ ਵੀ ਵਪਾਰ ਕੀਤਾ ਜਾਂਦਾ ਹੈ ਮੁਰਗੇ ਦਾ ਮੁਰਗੀਆਂ ਦਾ ਪੋਲਟਰੀ ਫਾਰਮ ਆਂਡਿਆਂ ਵਾਸਤੇ ਔਰ ਮੁਰਗੇ ਦੇ ਮੀਟ ਵਾਸਤੇ ਵੀ ਇਹਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ ਸਮੇਂ ਸਮੇਂ 'ਤੇ ਸਰਕਾਰ ਇਹਨਾਂ ਨੂੰ ਸਹੂਲਤਾਂ ਪੋਲਟਰੀ ਫਾਰਮ ਵਾਸਤੇ ਮੱਝਾਂ ਦੇ ਫਾਰਮਿੰਗ ਵਾਸਤੇ ਔਰ ਸਹੂਲਤਾਂ ਦਿੰਦੀ ਹੈ ਇਸੇ ਤਰ੍ਹਾਂ ਸਰਕਾਰੀ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਨੇ ਉਹ ਵੀ ਜਾਨਵਰਾਂ ਦੀ ਸਾਂਭ ਸੰਭਾਲ ਵਾਸਤੇ ਜਾਨਵਰ ਦੀ ਇੰਸ਼ੋਰੈਂਸ ਕਰਦੀ ਹੈ ਜਿਹਦੇ ਵਿੱਚ ਤਾਂ ਕਿ ਕਿਸੇ ਦਾ ਜ਼ਿਆਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਅਤੇ ਜੇ ਕਿਤੇ ਇਹ ਹੋ ਜਾਵੇ ਤਾਂ ਉਹਦੇ ਉਹਨੂੰ ਗਰੀਬ ਪਰਿਵਾਰ ਨੂੰ ਉਹਦੀ ਭਰਪਾਈ ਉਹਦੀ ਇੰਸ਼ੋਰੈਂਸ ਰਾਹੀਂ ਮਿਲ ਸਕੇ ਸਰਕਾਰ ਸਮੇਂ ਸਮੇਂ 'ਤੇ ਬੱਕਰੀ ਫਾਰਮ ਵਾਸਤੇ ਆਪਣੇ ਛੋਟੇ ਕੋਰਸ ਕਰਾਉਂਦੀ ਹੈ ਜਿਹਦੇ ਵਿੱਚ ਬੱਕਰੀ ਫਾਰਮਿੰਗ ਨਾਲ ਸੰਬੰਧਿਤ ਸਿਖਲਾਈ ਲੈ ਕੇ ਬੱਕਰੀ ਫਾਰਮ ਖੋਲ੍ਹਿਆ ਜਾ ਸਕਦਾ ਹੈ ਇਸੇ ਤਰ੍ਹਾਂ ਹੀ ਮੱਛੀ ਫਾਰਮ ਦਾ ਕੰਮ ਵੀ ਅਲੱਗ ਅਲੱਗ ਪਿੰਡਾਂ ਦੀਆਂ ਵਿੱਚ ਪਿੰਡਾਂ ਦੇ ਪੁਰਾਣੇ ਛੱਪੜਾਂ ਦੇ ਵਿੱਚ ਜਾਂ ਤਲਾਬ ਬਣਾ ਕੇ ਉੱਥੇ ਮੱਛੀ ਫਾਰਮ ਦਾ ਕੀਤਾ ਜਾਂਦਾ ਜਿਹਦੇ ਵਿੱਚ ਉਹ ਆਪਣਾ ਮੱਛੀ ਫਾਰਮਿੰਗ ਕਰ ਸਕਦੇ ਹਨ ਅਤੇ ਆਪਣਾ ਰੁਜ਼ਗਾਰ ਚਲਾ ਸਕਦੇ ਹਨ ਅਜਿਹੀਆਂ ਬਹੁਤ ਸਾਰੀਆਂ ਯੋਜਨਾਵਾਂ ਸਰਕਾਰ ਸਮੇਂ ਸਮੇਂ 'ਤੇ ਕਿਸਾਨਾਂ ਦੀ ਮਦਦ ਵਾਸਤੇ ਬਣਾਉਂਦੀ ਰਹਿੰਦੀ ਹੈ